ਉਂਝ ਤਾਂ ਪੂਰੇ ਪੰਜਾਬ ਵਿੱਚ ਕਈ ਕਲਾਕਾਰ ਨੇ ਕਈ ਵੱਖ ਵੱਖ ਕਲਾਕਾਰ ਨੇ ਜਿਵੇਂ ਕਿ ਕਈ ਨੱਚਣ ਵਾਲੇ ਨੇ ਅਤੇ ਕਈ ਗਾਣ ਵਾਲੇ ਨੇ ਅਤੇ ਕਈ ਹਸਾ ਹਸਾਉਣ ਵਾਲੇ ਨੇ ਅਤੇ ਆਦਿ ਕਈ ਕਲਾਕਾਰਾਂ ਨੂੰ ਤਾਂ ਲੋੜ ਲੋੜਵੰਦੀਆਂ ਮਹੱਤਵ ਵੀ ਮਿਲ ਜਾਂਦੀ ਹੈ ਅਤੇ ਮੌਕੇ ਵੀ ਮਿਲ ਜਾਂਦੇ ਨੇ ਜਿਸ ਕਰਕੇ ਉਹ ਆਪਣਾ ਸੁਨਹਿਰਾ ਭਵਿੱਖ ਬਣਾ ਸ ਬਣਾ ਦਿੰਦੇ ਨੇ ਪਰ ਕਈ ਕਲਾਕਾਰਾਂ ਨੂੰ ਨਾ ਮਹੱਤਵ ਮਿਲਦੀ ਹੈ ਅਤੇ ਨਾ ਮੌਕੇ ਮਿਲਦੇ ਨੇ ਅਤੇ ਇਹ ਦਾ ਕਈ ਵੱਖ ਵੱਖ ਕਾਰਨ ਨੇ ਜਿਵੇਂ ਕਿ ਕਈਆਂ ਦੇ ਘਰ ਦੇ ਨਹੀਂ ਮੰਨਦੇ ਕਿ ਉਹ ਇਹ ਕੰਮਾਂ ਨੂੰ ਇਹ ਕਲ ਕਾ ਕਲਾਕਾਰੀ ਨੂੰ ਛੱਡ ਦੇਣ ਅਤੇ ਬਾਕੀ ਕੋਈ ਹੋਰ ਕੰਮ ਦੇਖ ਲੈਣ ਕਿਉਂਕਿ ਉਹਨਾਂ ਦੇ ਘਰਦਿਆਂ ਨੂੰ ਲੱਗਦਾ ਹੈ ਕਿ ਇਸ ਕਲਾਕਾਰ ਵਿੱਚ ਕੁਝ ਨਹੀਂ ਰੱਖਿਆ ਪਰ ਉਹਨਾਂ ਦਾ ਉਹਨਾਂ ਦੀ ਇਹ ਕਲਾਕਾਰੀ ਸਭ ਦੇ ਵਿੱਚ ਨਹੀਂ ਹੁੰਦੀ ਉਹ ਕਲਾਕਾਰੀ ਉਹਨਾਂ ਦੀ ਕਲਾਕਾਰੀ ਹੈ ਅਤੇ ਉਹ ਕਲਾਕਾਰੀ ਨੂੰ ਉਹੀ ਬੰਦਾ ਕਰ ਸਕਦਾ ਹੈ ਜਿਸ ਨੂੰ ਰੱਬ ਦੀ ਦੇਣ ਹੋਵੇ ਅਤੇ ਇਹ ਮਹੱਤਵ ਅਤੇ ਮੌਕੇ ਵੱਖ ਕਈਆਂ ਨੂੰ ਮਿਲਦੇ ਨੇ ਅਤੇ ਕਈਆਂ ਨੂੰ ਨਹੀਂ ਮਿਲਦੇ ਅਤੇ ਇਹਨਾਂ ਦਾ ਇਹ ਕਾਰਨ ਨਾ ਕਰਕੇ ਉਹ ਕਲਾਕਾਰ ਆਪਣਾ ਭਵਿੱਖ ਸੁਨਹਿਰਾ ਨਹੀਂ ਬਣਾ ਪਾਉਂਦੇ ਅਤੇ ਹਮੇਸ਼ਾ ਆਪਣੀ ਜ਼ਿੰਦਗੀ ਨੂੰ ਕੋਸਦੇ ਨੇ ਕਿ ਮੇਰਾ ਭਵਿੱਖ ਕਾਸ਼ ਇਸੀ ਕਲਾਕਾਰੀ ਵਿੱਚ ਬਣ ਜਾਂਦਾ ਤਾਂ ਬੜਾ ਚੰਗਾ ਹੁੰਦਾ